ਹਾਂਜੀ ਕੰਪਿਊਟਰ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਸਮੇਂ ਵਿੱਚ ਹਰ ਜਗ੍ਹਾ 'ਤੇ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਸਕੂਲ ਸਭ ਤੋਂ ਪਹਿਲਾਂ ਦੇ ਸਕੂਲ ਵਿਚ ਕੰਪਿਊਟਰ ਬਹੁਤ ਹੀ ਜ਼ਰੂਰੀ ਆ ਕਿਸੇ ਬਿਲ ਨੂੰ ਬਣਾਉਣ ਵਿੱਚ ਕੰਪਿਊਟਰ ਮਦਦ ਕਰਦਾ ਆ ਹਰ ਕਲੀਨੀਕਲ 'ਚ ਕੰਪਿਊਟਰ ਮੌਜੂਦ ਹੈ ਹਰ ਮੋਲ ਵਿੱਚ ਕੰਪਿਊਟਰ ਮੌਜੂਦ ਆ ਕੰਪਿਊਟਰ ਸਾਡੀ ਪੜ੍ਹਾਈ ਵਿੱਚ ਵੀ ਬਹੁਤ ਜ਼ਰੂਰੀ ਆ ਕੰਪਿਊਟਰ ਦੀ ਵਰਤੋਂ ਹਰ ਇੱਕ ਚੀਜ਼ ਲਈ ਕੀਤੀ ਜਾਂਦੀ ਹੈ ਜਿਵੇਂ ਅਸੀਂ ਕੁਝ ਖਰੀਦਦੇ ਹਾਂ ਆਨਲਾਈਨ ਸ਼ੋਪਿੰਗ ਕਰਦੇ ਹਾਂ ਸ ਹਰ ਜਗ੍ਹਾ 'ਤੇ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ ਕੰਪਿਊਟਰ ਐਜੂਕੇਸ਼ਨ ਵਿੱਚ ਬਹੁਤ ਜ਼ਰੂਰੀ ਆ ਜਿਵੇਂ ਕਿ ਬੱਚੇ ਦੀ ਪੜ੍ਹਾਈ ਵਿੱਚ ਭਾਵੇਂ ਉਹ ਛੋਟੀ ਕਲਾਸ ਹੈ ਭਾਵੇਂ ਉਹ ਵੱਡੀ ਕਲਾਸ ਆ ਕੰਪਿਊਟਰ ਬਹੁਤ ਜ਼ਰੂਰੀ ਹੈ ਹੋਰ ਵੀ ਬਹੁਤ ਕੋਰਸ ਆ ਜੋ ਕਿ ਕੰਪਿਊਟਰ ਦੁਆਰਾ ਹੀ ਕੀਤੀ ਜਾਂਦੇ ਨੇ ਜਿਵੇਂ ਕੋਈ ਵੀ ਅਸੀਂ ਟੈਸਟ ਭਰਦੇ ਹਾਂ ਕੋਈ ਫੋਰਮ ਭਰਦੇ ਹਾਂ ਉਹ ਵੀ ਕੰਪਿਊਟਰ ਦੁਆਰਾ ਹੀ ਭਰਦੇ ਹਾਂ ਅਸੀਂ ਇਸ ਕਰਕੇ ਕੰਪਿਊਟਰ ਬਹੁਤ ਜ਼ਰੂਰੀ ਆ ਕੰਪਿਊਟਰ ਸਕੂਲਾਂ ਵਿੱਚ ਵੀ ਵਰਤੇ ਜਾਂਦੇ ਹਨ ਜੋ ਕਿ ਬਹੁਤ ਜ਼ਰੂਰੀ ਹੈ ਹੋਰ ਵੀ ਅੱਗੇ ਅਸੀਂ ਕੋਈ ਵੀ ਪੜ੍ਹਾਈ ਕਰਦੇ ਹਾਂ ਉਹ ਵੀ ਕੰਪਿਊਟਰ ਦੁਆਰਾ ਹੀ ਕਰਦੇ ਹਾਂ ਕ ਅੱਜ ਕੱਲ੍ਹ ਦੇ ਸਮੇਂ ਵਿੱਚ ਕੰਪਿਊਟਰ ਬਹੁਤ ਜ਼ਰੂਰੀ ਹੋ ਚੁੱਕਾ ਹੈ